ਹਾਂਜੀ ਮੇਰੇ ਕੋਲ ਬੁਣਾਈ ਨਾਲ ਸੰਬੰਧਿਤ ਬਹੁਤ ਸਾਰੇ ਟੀਚੇ ਅਤੇ ਇੱਛਾਵਾਂ ਹਨ ਮੈਂ ਆਪਣੇ ਹਸਬੈਂਡ ਦੇ ਸਵੈਟਰ 'ਤੇ ਕੰਮ ਕਰ ਰਹੀ ਹਾਂ ਅਤੇ ਆਪਣੇ ਬੱਚੇ ਦੇ ਪੈਰਾਂ ਦੇ ਮੋਜੇ ਬਣਾ ਰਹੀ ਹਾਂ ਮੈਨੂੰ ਬੁਣਾਈ ਕਰਨ ਦਾ ਸ਼ੌਕ ਬਾਰਵੀਂ ਜਮਾਤ ਦੇ ਬਾਅਦ ਹੀ ਪੈ ਗਿਆ ਸੀ ਮੇਰੀ ਇੱਛਾ ਸੀਗੀ ਕਿ ਮੈਂ ਬਾਰਵੀਂ ਜਮਾਤ ਤੋਂ ਬਾਅਦ ਬੁਣਾਈ ਕਰਨਾ ਸਿੱਖਾ ਅਤੇ ਮੈਂ ਆਪਣੀ ਦਾਦੀ ਕੋਲ ਬੈਠ ਜਾਂਦੀ ਸੀ ਅਤੇ ਉਹ ਜਦੋਂ ਬੁਣਦੇ ਸੀਗੇ ਅਤੇ ਮੈਂ ਉਹਨਾਂ ਨੂੰ ਦੇਖਦੀ ਸੀਗੀ ਕਿਸ ਕਿਸ ਤਰ੍ਹਾਂ ਉਹ ਬੁਣਦੇ ਆ ਅਤੇ ਉਹਨਾਂ ਤੋਂ ਦੇਖ ਦੇਖ ਕੇ ਮੈਂ ਇੱਦਾਂ ਹੀ ਬੁਣਨਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਯੂਟਿਊਬ ਤੋਂ ਦੇਖੇ ਕੁਛ ਡਿਜ਼ਾਇਨ ਉਸ ਤੋਂ ਦੇਖ ਦੇਖ ਕੇ ਹੁਣ ਮੈਂ ਕਾਫੀ ਵਧੀਆ ਬੁਣ ਲੈਂਦੀ ਹਾਂ ਮੈਂ ਇੱਕ ਦਿਨ ਆਪਣਾ ਖੁਦ ਦਾ ਬੁਣਾਈ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹਾਂ ਮੈਂ ਵੱਖ ਵੱਖ ਕਿਸਮਾਂ ਦੇ ਕੱਪੜੇ ਬਣਾਉਣਾ ਚਾਹੁੰਦੀ ਹਾਂ ਜਿਵੇਂ ਕਿ ਸਵੈਟਰ ਟੋਪੀਆਂ ਅਤੇ ਸਕਾਫ ਮੈਂ ਬੱਚਿਆਂ ਲਈ ਖਿਡੌਣੇ ਵੀ ਬਣਾਉਣਾ ਚਾਹੁੰਦੀ ਹਾਂ ਮੈਂ ਆਪਣੀ ਬੁਣਾਈ ਨਾਲ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੀ ਹਾਂ ਧੰਨਵਾਦ ਜੀ